ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਵਣ ਵਿਭਾਗ ਤੋਂ ਬੋਲ ਰਹੇ ਹਾਂ ਜੀ ਹਾਂਜੀ ਹਾਂਜੀ ਕਿੱਥੋਂ ਹਾਂਜੀ ਹਾਂਜੀ ਹਾਂਜੀ ਅਤੇ ਦੇਖੋ ਜੀ ਅੱਜ ਹਾਂਜੀ ਹਾਂਜੀ ਮੈਂ ਐਕਚੁਲੀ ਅੱਜ ਦੇ ਸਮੇਂ 'ਤੇ ਨਾ ਮਾਹੌਲ ਵੀ ਬਹੁਤ ਖ਼ਰਾਬ ਹੋ ਰੱਖਿਆ ਗਾ ਅਤੇ ਆਪਣੀ ਓਜੋਨ ਲੇਅਰ ਜਿਹੜੀ ਹੈਗੀ ਆ ਉਹ ਵੀ ਬਹੁਤ ਖ਼ਰਾਬ ਹੋ ਗਈ ਹੈ ਅਤੇ ਲੋਕਾਂ ਵਾਸਤੇ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਹੈ ਨਾ ਅਤੇ ਤੁਹਾਨੂੰ ਰੁੱਖ ਬੂਟੇ ਤਾਂ ਜ਼ਿਆਦਾ ਤੋਂ ਜ਼ਿਆਦਾ ਲਗਾਉਣੇ ਚਾਹੀਦੇ ਆ ਜਿਹੜੇ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਹੁਣ ਸਰਦੀਆਂ ਦੇ ਵਿੱਚ ਹਾਂਜੀ ਹਾਂਜੀ ਸਰਦੀਆਂ ਦੇ ਵਿੱਚ ਤੁਸੀਂ ਆਪਣੇ ਬਗੀਚੇ 'ਚ ਫੁੱਲ ਲਾ ਸਕਦੇ ਹੋ ਫੁੱਲ ਬੂਟੇ ਜਿਵੇਂ ਗੇਂਦਾ ਹੋ ਗਿਆ ਜੀ ਅਤੇ ਉਹ ਚੰਪਾ ਹੋ ਗਿਆ ਇੱਦਾਂ ਦੇ ਫੁੱਲ ਬੂਟੇ ਲਾ ਸਕਦੇ ਹੋ ਤੁਸੀਂ ਅਤੇ ਧਨੀਆ ਬੀਜ ਲਓ ਮੇ ਮੇਥੀ ਹੋ ਗਈ ਜੀ ਮੇਥੀ ਸਰਦੀਆਂ 'ਚ ਹੋ ਜਾਂਦੀ ਆ ਮਟਰਾਂ ਹੋ ਜਾਂਦੀਆਂ ਜੀ ਹਾਂਜੀ ਦੇਖਭਾਲ ਜੀ ਇਹਨਾਂ ਨੂੰ ਦੇਖੋ ਪ ਤਾਂ ਚਾਹੀਦੀ ਚਾਹੀਦੀ ਹੈ ਅਤੇ ਪਾਣੀ ਦੀ ਬਹੁਤ ਜ਼ਿਆਦਾ ਲੋੜ ਨਹੀਂ ਹੁੰਦੀ ਗੀ ਪਰ ਇਹ ਹੈ ਤੁਸੀਂ ਇੱਕ ਦਿਨ ਛੱਡ ਕੇ ਪਾਣੀ ਲਗਾਈ ਜਾਓ ਇਹਨਾਂ ਨੂੰ ਖਾਦ ਵਧੀਆ ਚੰਗੀ ਖਾਦ ਦੇਵਾਂਗੇ ਆਪਾਂ ਅਤੇ ਫਿਰ ਬੂਟੇ ਵਧੀਆ ਰਹਿਣਗੇ ਅਤੇ ਬਾਕੀ ਸਮੇਂ 'ਤੇ ਆ ਕੇ ਤੁਸੀਂ ਇੱਥੇ ਵਣ ਵਿਭਾਗ 'ਚ ਆ ਕੇ ਇੱਥੇ ਅਸੀਂ ਸੈਮੀਨਾਰ ਲਗਾਉਂਦੇ ਰਹਿੰਦੇ ਕੈਂਪ ਲਗਾਉਂਦੇ ਤੁਸੀਂ ਇੱਥੇ ਆਓ ਅਤੇ ਇੱਥੇ ਵੇਖੋ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਇਹ ਜੀ ਹਫ਼ਤੇ ਦੋ ਹਫ਼ਤੇ ਦੇ ਵਿੱਚ ਇੱਕ ਵਾਰੀ ਲਗਾ ਲੈਂਦੇ ਹਾਂ ਸੈਮੀਨਾਰ ਤੁਸੀਂ ਸ਼ਨੀਵਾਰ ਤੇ ਸ਼ਨੀਵਾਰ ਇੱਥੇ ਆਉਂਦੇ ਹੈਗੇ ਆ ਹੋਰ ਟੀਚਰਸ ਆਉਂਦੇ ਆ ਉਹ ਜਾਣਕਾਰੀ ਦਿੰਦੇ ਆ ਅਤੇ ਤੁਸੀਂ ਇੱਥੇ ਆਓ ਇੱਕ ਵਾਰੀ ਅਤੇ ਆ ਕੇ ਬੈਠੋ ਤੁਹਾਡੇ ਵਰਗੇ ਹੋਰ ਨੌਜਵਾਨ ਪੀੜ੍ਹੀ ਦੇ ਲੋਕ ਇੱਥੇ ਆਉਂਦੇ ਆ ਅਤੇ ਤੁਸੀਂ ਜਾਣਕਾਰੀ ਲਓ ਅਤੇ ਵੱਧ ਤੋਂ ਵੱਧ ਜਿੰਨਾ ਹੋ ਸਕੇ ਤੁਸੀਂ ਰੁੱਖ ਬੂਟੇ ਲਗਾਓ ਤਾਂ ਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾ ਸਕੀਏ ਹਾਂਜੀ ਜ਼ਰੂਰ ਜੀ ਹਾਂਜੀ ਅੱਜ ਕੱਲ੍ਹ ਪਰਾਲੀਆਂ ਹਾਂਜੀ ਹਾਂਜੀ ਪਰਾਲੀਆਂ ਦੇ ਕਰਕੇ ਜਿਹੜਾ ਮਾਹੌਲ ਜਿਹੜਾ ਖ਼ਰਾਬ ਹੋਇਆ ਪਿਆ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਵੀ ਅਸੀਂ ਕਿਸਾਨਾਂ ਨੂੰ ਵੀ ਅਸੀਂ ਜਾਗਰੂਕ ਕਰ ਰਹੇ ਹਾਂ ਉਹਨਾਂ ਨੂੰ ਵੀ ਦੱਸ ਰਹੇ ਹਾਂ ਵੀ ਜਲਾਉਣਾ ਕੋਈ ਹੱਲ ਨਹੀਂ ਹੈਗਾ ਗਾ ਬਾਕੀ ਤੁਸੀਂ ਇੱਕ ਵਾਰੀ ਆਓ ਜੀ ਬਾਕੀ ਜਾਣਕਾਰੀ ਤੁਹਾਨੂੰ ਇੱਥੇ ਦਿੱਤੀ ਜਾਵੇਗੀ ਪੂਰੀ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਬਾਕੀ ਹੋਰ ਕਿਸੇ ਪ੍ਰਕਾਰ ਤੁਹਾਨੂੰ ਬੀਜ ਚਾਹੀਦੇ ਆ ਖਾਦ ਚਾਹੀਦੇ ਹੈ ਤੁਸੀਂ ਇੱਥੇ ਆ ਸਕਦੇ ਹੋ ਠੀਕ ਹੈ ਜੀ ਠੀਕ ਹੈ ਓਕੇ ਜੀ ਧੰਨਵਾਦ ਜੀ ਧੰਨਵਾਦ ਹਾਂਜੀ ਤੁਹਾਡਾ ਬਹੁਤ ਬਹੁਤ